ਵੈਸੇ ਤਾਂ ਪੰਜਾਬੀ ਨੱਚਦੇ ਹੀ ਰਹਿੰਦੇ ਹਾਂ ਜਿਵੇਂ ਕਿ ਵਿਆਹ ਵਿੱਚ ਲਾੜਾ ਉਸ ਦੇ ਰਿਸ਼ਤੇਦਾਰ ਭੈਣ ਭਰਾ ਸਾਰੇ ਹੀ ਖੁਸ਼ੀ ਵਿੱਚ ਨੱਚਦੇ ਹਨ ਜਿਵੇਂ ਕਿ ਲਾੜੇ ਦਾ ਫਾਦਰ ਮੰਮੀ ਡੈਡੀ ਸਭ ਨੱਚਦੇ ਰਹਿੰਦੇ ਹਨ ਔਰ ਰਿਸ਼ਤੇਦਾਰ ਵੀ ਖੂਬ ਅਨੰਦ ਲੈਂਦੇ ਹਨ ਅਤੇ ਨੱਚਦੇ ਹਨ ਇਸ ਤੋਂ ਇਲਾਵਾ ਵਿਸਾਖੀ ਨੂੰ ਲੋਕ ਫਸਲਾਂ ਵੱਢ ਕੇ ਹੋਲੇ ਮਹੱਲੇ 'ਤੇ ਜਾਣ ਵੇਲੇ ਨੱਚਦੇ ਟੱਪਦੇ ਹੀ ਜਾਂਦੇ ਹਨ ਪੰਜਾਬ ਵਿੱਚ ਲੋਕ ਹਰ ਸਮੇਂ ਨੱਚਦੇ ਟੱਪਦੇ ਹੀ ਰਹਿੰਦੇ ਹਨ ਹਰੇਕ ਖੁਸ਼ੀ ਦੇ ਮੌਕੇ ਨੱਚਦੇ ਹਨ